ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਪਹਿਲੇ ਦੇ ਸਮਿਆਂ ਵਿੱਚ ਲੋਕ ਚਿੱਠੀ ਦੁਆਰਾ ਜਾਂ ਪੱਤਰ ਦੁਆਰਾ ਆਪਣਾ ਸੰਦੇਸ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਸਨ ਜੋ ਕਿ ਕਈ ਵਾਰ ਸਮੇਂ ਸਿਰ ਨਹੀਂ ਵੀ ਪਹੁੰਚਦਾ ਸੀ ਅੱਜ ਕੱਲ੍ਹ ਨਵੀਆਂ ਤਕਨੀਕਾਂ ਕਰਕੇ ਮੋਬਾਇਲ ਫੋਨ ਸ਼ੁਰੂ ਹੋ ਗਏ ਹਨ ਜਿਸ ਕਰਕੇ ਆਪਾਂ ਕੁਝ ਮਿੰਟਾਂ ਵਿੱਚ ਹੀ ਆਪਣਾ ਸੰਦੇਸ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਲੈਂਦੇ ਹਾਂ ਮੋਬਾਇਲ ਫੋਨ ਦਾ ਮਨੁੱਖ ਨੇ ਕੋਈ ਬਹੁਤ ਵੱਡਾ ਫਾਇਦਾ ਹੋਇਆ ਹੈ ਕਿ ਹ ਭਾਰਤ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਮਿੰਟਾਂ ਵਿੱਚ ਹੀ ਗੱਲਾਂ ਕਰ ਸਕਦਾ ਹੈ ਮੈਨੂੰ ਕਈ ਵਾਰ ਅਨਮੋਲ ਕਵਾਤਰਾ ਨਾਮ ਦਾ ਮੁੰਡਾ ਯਾਦ ਆਉਂਦਾ ਹੈ ਜੋ ਕਿ ਇੱਕ ਪੰਜਾਬੀ ਨੌਜਵਾਨ ਹੈ ਉਹ ਪਹਿਲਾਂ ਵਿਦੇਸ਼ ਗਿਆ ਉੱਥੇ ਜਾ ਕੇ ਉਹਨੇ ਕਾਫੀ ਕਮਾਈ ਕੀਤੀ ਫਿਰ ਉਹ ਵਾਪਸ ਪੰਜਾਬ ਵਿੱਚ ਆ ਗਿਆ ਇੱਥੇ ਵਾਪਸ ਇੱਥੇ ਵਾਪਸ ਆ ਕੇ ਉਹਨੇ ਕਾਫੀ ਲੋਕਾਂ ਦੀ ਮਦਦ ਕੀਤੀ ਉਹਨੇ ਆਪਣੀ ਕਮਾਈ ਵਿੱਚੋਂ ਇੱਕ ਐਨਜੀਓ ਵੀ ਖੋਲਿਆ ਉਸ ਵਿੱਚ ਉਹਨੇ ਕਾਫੀ ਗਰੀਬ ਲੋਕਾਂ ਦੀ ਗਰੀਬ ਇਸਤਰੀਆਂ ਦੀ ਅਤੇ ਬਹੁਤ ਲੋਕਾਂ ਦੀ ਉਹਨੇ ਮਦਦ ਕੀਤੀ ਹੋਰ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਤਕਨੀਕਾਂ ਨੇ ਮਨੁੱਖਾਂ ਦਾ ਬਹੁਤ ਸਾਥ ਦਿੱਤਾ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਕਾਫੀ ਚੱਲ ਰਿਹਾ ਹੈ ਜਿਹੜੇ ਅੱਜ ਕੱਲ੍ਹ ਸਕੂਲ ਵਿੱਚ ਅਧਿਆਪਕ ਪੜ੍ਹਾਉਂਦੇ ਹਨ ਉਹ ਵਿ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੁਆਰਾ ਵੀ ਕਾਫੀ ਸੋਸ਼ਲ ਮੀਡੀਆ ਤੋਂ ਵੀ ਉਹ ਕਾਫੀ ਜਾਣੂ ਕਰਵਾ ਰਹੇ ਹਨ ਉਹਨਾਂ ਨੂੰ ਸਮਾਜਿਕ ਸਿੱਖਿਆ ਵੀ ਦੇ ਰਹੇੇ ਹਨ ਇਸ ਤੋਂ ਇਲਾਵਾ ਸਕੂਲ ਅਤੇ ਕਾਲਜਾਂ ਵਿੱਚ ਵੀ ਟੈਕਨੋਲੋਜੀ ਸੈਕਟਰ ਚਲਾਏ ਜਾ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ ਜਾ ਰਿਹਾ ਹੈ ਉਹਨਾਂ ਉਹਨਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪ੍ਰੋਫੈਸ਼ਨ ਨੂੰ ਸਹੀ ਤਰੀਕੇ ਨਾਲ ਅ ਚੁਣ ਸਕਣ ਅਤੇ ਹੋਰ ਸੋਸਾਇਟੀ ਵਿੱਚ ਅਸ ਅ ਤਰ੍ਹਾਂ ਤਰ੍ਹਾਂ ਦੀ ਸੁਸਾਇਟੀਆਂ ਵਿੱਚ ਵੀ ਟੈਕਨੋਲੋਜੀ ਸੈਕਟਰ ਚਲਾਏ ਜਾ ਰਹੇ ਹਨ ਅ ਕਿ ਸਮਾਜ ਨੂੰ ਟੈਕਨਾਲੋ ਅ ਅ ਸਮਾਜ ਨੂੰ ਤਕਨੀਕਾਂ ਬਾਰੇ ਪਤਾ ਲੱਗੇ ਨਵੀਆਂ ਨਵੀਆਂ ਤਕਨੀਕਾਂ ਬਾਰੇ ਪਤਾ ਲੱਗੇ ਉਹਨਾਂ ਨੂੰ ਉ ਥੋ ਤਕਨੀਕਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਵੀ ਕਾਫੀ ਟੈਕਨੋਲੋਜੀ ਸੈਕਟਰ ਚਲਾ ਰਹੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਹਨ ਉਹ ਆਪਣੇ ਟੈਕਨੋਲੋਜੀ ਨਾਲ ਟੈਕਨੋਲੋਜੀ ਦੇ ਸੰਪਰਕ ਵਿੱਚ ਰਹਿਣ ਧੰਨਵਾਦ